ਮੋਹਾਲੀ ਇੱਕ ਇੰਡਸਟਰੀਅਲ ਏਰੀਆ ਹੈ ਇੱਥੇ ਬਹੁਤ ਸਾਰੀਆਂ ਫੈਕਟਰੀਆਂ ਹਨ ਜਿਨ੍ਹਾਂ ਕਰਕੇ ਲੋਕਾਂ ਨੂੰ ਕਾਫ਼ੀ ਰੁਜ਼ਗਾਰ ਮਿਲਿਆ ਹੈ ਅਤੇ ਇਸ ਚੰਡੀਗੜ੍ਹ ਨਜ਼ਦੀਕ ਹੋਣ ਕਾਰਨ ਹੀ ਮੋਹਾਲੀ ਦਾ ਜ਼ਿਆਦਾ ਵਕਾ ਵਿਕਾਸ ਹੋਇਆ ਹੈ ਅਤੇ ਇੱਥੇ ਹਸ ਹੋਸਪੀਟਲ ਵਗੈਰਾ ਸਕੂਲ ਬਹੁਤ ਹਨ ਜਿਨ੍ਹਾਂ ਕਾਰਨ ਲੋਕਾਂ ਨੂੰ ਬਹੁਤ ਜ਼ਿਆਦਾ ਮਤਲਬ ਰੁਜ਼ਗਾਰ ਮਿਲਿਆ ਹੈ ਜਿਸ ਕਾਰਨ ਉਹਨਾਂ ਦੀ ਆਰਥਿਕ ਦਸ਼ਾ ਵੀ ਸੁਧਾਰ ਆਇਆ ਹੈ ਅਤੇ ਲੋਕ ਛੋਟੇ ਮੋਟੇ ਧੰਦੇ ਵੀ ਕਰਦੇ ਹਨ ਜਿਸ ਨਾਲ਼ ਮੋਹਾਲੀ ਇੱਕ ਵਧੀਆ ਅਤੇ ਵਧੀਆ ਵਿਕਾਸ ਹੋਇਆ ਹੈ ਇਹਨਾਂ ਦਿਨਾਂ ਵਿੱਚ ਅਤੇ ਇੱਕ ਜਿਹੜਾ ਹੈਗਾ ਹੈ ਕਿ ਚੰਡੀਗੜ੍ਹ ਨੇੜੇ ਹੋਣ ਕਾਰਨ ਸਕੂਲਾਂ ਅਤੇ ਹੋਸਪੀਟਲਾਂ ਕਰਕੇ ਲੋਕ ਕਾਫ਼ੀ ਪੀਜੀ ਵਗੈਰਾ ਖੋਲ੍ਹ ਲਏ ਹਨ ਉਹ ਵੀ ਇੱਕ ਰੁਜ਼ਗਾਰ ਦਾ ਸਾਧਨ ਬਣ ਗਿਆ ਲੋਕਾਂ ਲਈ ਅਤੇ ਬਾਕੀ ਜਿਹੜੇ ਹੈਗਾ ਇੱਕ ਬਾਰਿਸ਼ ਦੇ ਦਿਨਾਂ ਵਿੱਚ ਇੱਥੇ ਬਹੁਤ ਬੁਰਾ ਹਾਲ ਹੋ ਜਾਂਦਾ ਹੈ ਜਿਹੜਾ ਪਾਣੀ ਹੈ ਗਲੀਆਂ ਅਤੇ ਘਰਾਂ ਵਿੱਚ ਵੜ ਜਾਂਦਾ ਹੈ ਜਿਸ ਕਾਰਨ ਕਾਫ਼ੀ ਬਿਮਾਰੀਆਂ ਵੀ ਫੈਲ ਜਾਂਦੀਆਂ ਹੈ ਜਿਵੇਂ ਡਾਇਰੀਆ ਵਗੈਰਾ ਹੋਇਆ ਅਤੇ ਗੌਰਮਿੰਟ ਨੂੰ ਇਹਨਾਂ ਗੱਲਾਂ ਵੱਲ ਧਿਆਨ ਦੇਣ ਦੀ ਲੋੜ ਹੈ ਕਿ ਜਿਹੜਾ ਪਾਣੀ ਦਾ ਉਹਦਾ ਸਹੀ ਵਿਕਾਸ ਹੋਵੇ ਤਾਂ ਕਿ ਲੋਕਾਂ ਨੂੰ ਸਹੀ ਸਹੂਲਤ ਮਿਲ ਸਕੇ